ਸਾਡੇ ਰਾਜ ਦੇ ਸਾਡੇ ਪੰਜਾਬ ਦੇ ਸੱਭਿਆਚਾਰਕ ਕੱਪੜਿਆਂ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦਾ ਸਲਵਾਰ ਸੂਟ ਪਟਿਆਲਾ ਸ਼ਾਹੀ ਸਲਵਾਰ ਅਤੇ ਜਿੱਥੇ ਅਸੀਂ ਗਹਿਣਿਆਂ ਦੀ ਗੱਲ ਕਰੀਏ ਤਾਂ ਉੱਥੇ ਝਾਂਜਰਾਂ ਮੱਥੇ ਟਿੱਕਾ ਝੁਮਕੇ ਜੋ ਕਿ ਪੰਜਾਬ ਦੇ ਵਿੱਚ ਹਰ ਮੁਟਿਆਰ ਪਾ ਕੇ ਰੱਖਦੀ ਹੈ ਅਤੇ ਇਹ ਸਭ ਚੀਜ਼ਾਂ ਹੋ ਗਈਆਂ ਪੰਜਾਬੀ ਸੂਟ ਹੋ ਗਿਆ ਪੰਜਾਬੀ ਜੁੱਤੀ ਹੋ ਗਈ ਪੰਜਾਬੀ ਗਹਿਣੇ ਹੋ ਗਏ ਆ ਸਭ ਚੀਜ਼ਾਂ ਸਾਡੇ ਪੰਜਾਬ ਨੂੰ ਬਾਕੀ ਖੇਤਰਾਂ ਤੋਂ ਵੱਖਰਾ ਕਰ ਦਿੰਦੀਆਂ ਨੇ ਪੰਜਾਬ ਦੇ ਮੁਟਿਆਰਾਂ ਸਲਵਾਰ ਸੂਟ ਪਾ ਕੇ ਪੰਜਾਬੀ ਜੁੱਤੀ ਭੱਜ ਪਾ ਕੇ ਅਤੇ ਪੰਜਾਬੀ ਗਹਿਣੇ ਅਤੇ ਨਾਲ ਉਹਦੇ ਪਰਾਂਦਾ ਪਾ ਕੇ ਜਦੋਂ ਕਿੱਥੇ ਵੀ ਜਾਂਦੀਆਂ ਨੇ ਤਾਂ ਉਹ ਪੰਜਾਬ ਦੀ ਮੁਟਿਆਰ ਦੀ ਇੱਕ ਵੱਖਰੀ ਹੀ ਪਹਿਚਾਣ ਹੁੰਦੀ ਹੈ ਕਿ ਪੰਜਾਬਣ ਆਈ ਹੈ ਅਤੇ ਪੰਜਾਬਣ ਦਾ ਪੰਜਾਬੀ ਮੁਟਿਆਰ ਦਾ ਮੁਕਾਬਲਾ ਤਾਂ ਕਿੱਥੇ ਵੀ ਨਹੀਂ ਹੈਗਾ ਅਤੇ ਇਹ ਸਾਨੂੰ ਪੰਜਾਬੀ ਪਹਿਰਾਵਾ ਹੈ ਬਾਕੀ ਸਾਰੇ ਇਲਾਕਿਆਂ ਤੋਂ ਸਾਨੂੰ ਵੱਖਰਾ ਹੀ ਕਰ ਦਿੰਦਾ ਹੈ ਕਿ ਇਹ ਪੰਜਾਬ ਦੇ ਲੋਕ ਹਨ